ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਮੈਨੂੰ ਕੁਕਿੰਗ ਦਾ ਸ਼ੁਰੂ ਤੋਂ ਹੀ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਅਤੇ ਕੁਕਿੰਗ ਦੇ ਵਿੱਚ ਮੈਂ ਬਹੁਤ ਹੀ ਜ਼ਿਆਦਾ ਮਸਾਲੇ ਇਸਤੇਮਾਲ ਕਰਦੀ ਰਹੀ ਹਾਂ ਇਹ ਮਸਾਲੇ ਮੈਂ ਜ਼ਿਆਦਾਤਰ ਆਪਣੇ ਹੱਥਾਂ ਦੇ ਨਾਲ ਆਪਣੇ ਘਰ ਹੀ ਬਣਾਉਂਦੀ ਹਾਂ ਜਿਸ ਦੇ ਕਾਰਨ ਇਹ ਮਸਾਲੇ ਬਹੁਤ ਹੀ ਸ਼ੁੱਧ ਬਣਦੇ ਹਨ ਬਾਹਰਲੇ ਮਸਾਲੇ ਅਕਸਰ ਹੀ ਅਸ਼ੁੱਧ ਹੁੰਦੇ ਹਨ ਜਿਨ੍ਹਾਂ ਵਿੱਚ ਬਹੁਤ ਹੀ ਜ਼ਿਆਦਾ ਹੋਰ ਚੀਜ਼ਾਂ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਇਸ ਕਰਕੇ ਮੈਂ ਮਸਾਲੇ ਖੁਦ ਬਣਾਉਂਦੀ ਹਾਂ ਇਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਹਨ ਜਿਵੇਂ ਕਿ ਮੈਂ ਕੇਕ ਨੂੰ ਉਸ ਦੇ ਨੀਚੇ ਬੈ ਬ੍ਰੈੱਡ ਦੀ ਜਗ੍ਹਾ 'ਤੇ ਕੁਛ ਪਾਊਡਰ ਇਸਤੇਮਾਲ ਕਰਕੇ ਕੇਕ ਨੂੰ ਬਣਾ ਲੈਂਦੀ ਹਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਦੁਰਲਭ ਅਸਾਧਾਰਨ ਸਮੱਗਰੀਆਂ ਦੇ ਨਾਲ ਯੂਸ ਕਰਕੇ ਉਹਨਾਂ ਨੂੰ ਅਸ਼ਸਤਰ ਆਪਣੇ ਬਣਾ ਕੇ ਉਹਨੂੰ ਬਣਾਉਂਦੀ ਹਾਂ ਜਿਹਦੇ ਨਾਲ ਕਿ ਮੇਰੀ ਖਾਣ ਦੀ ਚੀਜ਼ ਬਹੁਤ ਹੀ ਸਵਾਦ ਬਣਦੀ ਹੈ ਅਤੇ ਦੂਸਰੇ ਲੋਕਾਂ ਨੂੰ ਵੀ ਉਹ ਖਾਣ ਦੇ ਵਿੱਚ ਬਹੁਤ ਮਜ਼ਾ ਆਉਂਦਾ ਹੈ ਹੋਰ ਵੀ ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਜਿੱਦ ਜਿਨ੍ਹਾਂ ਨੂੰ ਮੈਂ ਆਪਣੇ ਤਰੀਕੇ ਦੇ ਨਾਲ ਆਪਣੇ ਮਸਾਲਿਆਂ ਨੂੰ ਇਸਤੇਮਾਲ ਕਰਕੇ ਬਣਾਉਂਦੀ ਹਾਂ ਅਤੇ ਇਸ ਕਰਕੇ ਉਹ ਦੂਸਰੇ ਵਿਅਕਤੀ ਨੂੰ ਖਾਣ ਵਿੱਚ ਵੀ ਵਧੀਆ ਲੱਗਦੇ ਹਨ ਜਿਨ੍ਹਾਂ ਦੇ ਕਾਰਨ ਉਹਨਾਂ ਦੇ ਸ਼ਰੀਰ 'ਤੇ ਕੋਈ ਵੀ ਨੁਕਸਾਨ ਨਹੀਂ ਆਉਂਦਾ ਜਿਹਦੇ ਕਾਰਨ ਉਹਨਾਂ ਦਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਅਤੇ ਮੈਨੂੰ ਵੀ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਹੈ ਜਦੋਂ ਮੈਂ ਕਿਸੇ ਨੂੰ ਆਪਣੇ ਹੱਥ ਦੇ ਬਣੇ ਮਸਾਲਿਆਂ ਦੇ ਨਾਲ ਕੁਛ ਖਵਾਉਂਦੀ ਹਾਂ ਉਹਨਾਂ ਨੂੰ ਉਹ ਜਦੋਂ ਮੇਰਾ ਧੰਨਵਾਦ ਕਰਦੇ ਹਨ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਧੰਨਵਾਦ ਜੀ